ਮੇਰੇ ਅਨੁਸਾਰ ਭੰਗੜਾ ਐਰੋਬਿਕਸ ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਦਰਸਾਉਂਦਾ ਹੈ ਭੰਗੜਾ ਐਰੋਬਿਕਸ ਪੰਜਾਬ ਦੇ ਸੰਸਕ੍ਰਿਤਿਕ ਵਿਰਸੇ ਨੂੰ ਬਹੁਤ ਹੀ ਵਿਅਕਤ ਕਰਦਾ ਹੈ ਕਿਉਂਕਿ ਇਹ ਭੰਗੜੇ ਜੋ ਕਿ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਨੂੰ ਆਧੁਨਿਕ ਐਰੋਬਿਕਸ ਦੇ ਤਰੀਕਿਆਂ ਨਾਲ ਮਿਲਾ ਕੇ ਇੱਕ ਨਵਾਂ ਰੂਪ ਦਿੰਦਾ ਹੈ ਭੰਗੜਾ ਸਿਰਫ ਇੱਕ ਨਾਚ ਹੀ ਨਹੀਂ ਸਗੋਂ ਇਹ ਪੰਜਾਬ ਦੀ ਰੰਗਤ ਜੋਸ਼ ਅਤੇ ਉਤਸ਼ਾਹ ਦਾ ਪ੍ਰਤੀਕ ਹੈ ਭੰਗੜਾ ਐਰੋਵਿਕਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿਰਫ ਮਨੋਰੰਜਨ ਅਤੇ ਤੰਦਰੁਸਤੀ ਪੱਖੀ ਸੀਮਤ ਨਹੀਂ ਰਹਿੰਦੀ ਸਗੋਂ ਕੇ ਨੌਜਵਾਨ ਪੀੜ੍ਹੀ ਨੂੰ ਆਪਣੇ ਸੰਸਕਾਰਾਂ ਨਾਲ ਜੋੜਨ ਦਾ ਵੀ ਇੱਕ ਸਰੋਤ ਹੈ ਪੁਰਾਤਨ ਸਮਿਆਂ ਵਿੱਚ ਭੰਗੜਾ ਖੇਤੀਬਾੜੀ ਅਤੇ ਫਸਲਾਂ ਦੀ ਕਟਾਈ ਦੌਰਾਨ ਖੁਸ਼ੀ ਮਨਾਉਣ ਲਈ ਕੀਤਾ ਜਾਂਦਾ ਸੀ ਪਰ ਅੱਜ ਇਹ ਵੱਖ ਵੱਖ ਰੂਪਾਂ ਵਿੱਚ ਵਿਸ਼ਵ ਪੱਧਰ 'ਤੇ ਪ੍ਰਸਿੱਧ ਹੋ ਚੁੱਕਾ ਹੈ ਭੰਗੜਾ ਐਰੋਬਿਕਸ ਸਿਹਤ ਲਈ ਇੱਕ ਬੇਹਤਰ ਅਭਿਆਸ ਹੈ ਜਿਸ ਨੂੰ ਨਵੀਂ ਪੀੜ੍ਹੀ ਨੇ ਇੱਕ ਵਧੀਆ ਵਿਆਮ ਦੇ ਤੌਰ 'ਤੇ ਅਪਣਾਇਆ ਹੈ ਇਹ ਸਰੀਰਕ ਫਾਇਦੇ ਹੋਣ ਦੇ ਨਾਲ ਨਾਲ ਲੋਕਾਂ ਨੂੰ ਪਿਆਰ ਭਾਈਚਾਰੇ ਅਤੇ ਉਤਸ਼ਾਹ ਦੀ ਮਹਿਸੂਸ ਕਰਵਾਉਂਦਾ ਹੈ ਭੰਗੜਾ ਦੇ ਤੁਰੰਤ ਲੈ ਕੇ ਗੀਤਾਂ ਦੀ ਗੂੰਜ ਅਤੇ ਜ਼ੋਰਦਾਰ ਭਾਵਨਾਵਾਂ ਦਾ ਮਿਲਾਪ ਪੂਰੀ ਤਰਾਂ ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ਪੇਸ਼ ਕਰਦਾ ਹੈ ਇਸ ਤਰੀਕੇ ਨਾਲ ਭੰਗੜਾ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਅਤੇ ਉਹਨਾਂ ਦੀ ਨਵੀਂ ਪੀੜ੍ਹੀ ਤੱਕ ਪਹੁੰਚ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਭੰਗੜਾ ਸਰੀਰ ਨੂੰ ਤੰਦਰੁਸਤ ਰੱਖਣ ਲਈ ਵੀ ਬਹੁਤ ਵਧੀਆ ਹੈ ਇਹ ਐਕਸਰਸਾਈਜ਼ ਦੀ ਤਰ੍ਹਾਂ ਵੀ ਇਸ ਨੂੰ ਲਿਆ ਜਾ ਸਕਦਾ ਹੈ